ਬੱਚਿਆਂ ਨੂੰ ਸਕੂਲ ਦੇ ਸਿਲੇਬਸ ਵਿੱਚ ਬੈਂਕ ਦੇ ਵਰਕਫਲੋ ਨੀਤੀਆਂ ਕਰਜ਼ਿਆਂ ਰਿਟਰਨ ਟੈਕਸ ਆਦਿ ਸਿਖਾਉਣ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਅਸੀਂ ਬੱਚਿਆਂ ਨੂੰ ਇਹ ਸਾਰੀਆਂ ਚੀਜ਼ਾਂ ਨਹੀਂ ਸਿਖਾਉਂਦੇ ਤਾਂ ਵੱਡੇ ਹੋ ਕੇ ਬੱਚਿਆਂ ਨੂੰ ਆਪਣੇ ਕੰਮਕਾਰ ਬੈਂਕ ਵਿੱਚ ਕਰਨ ਲਈ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਜੇ ਅਸੀਂ ਉਹਨਾਂ ਨੂੰ ਬਚਪਨ ਵਿੱਚ ਬੈਂਕ ਦਾ ਸਾਰਾ ਕੰਮ ਸਿਖਾ ਦਿੰਦੇ ਹਾਂ ਜਾਂ ਪੜ੍ਹਾ ਦਿੰਦੇ ਹਾਂ ਤਾਂ ਉਹ ਉਹਨਾਂ ਲਈ ਬਹੁਤ ਫਾਇਦੇ ਲਈ ਹੁੰਦਾ ਹੈ ਧੰਨਵਾਦ